ਖੁੱਲ੍ਹੇ ਪਾਣੀ ਵਿੱਚ ਸਵੀਮਿੰਗ ਕਰਨਾ ਸਭ ਤੋਂ ਜ਼ਿਆਦਾ ਡਿਫੀਕਲਟ ਹੈਗਾ ਆ ਉਹਦੇ 'ਚ ਸਭ ਤੋਂ ਜ਼ਿਆਦਾ ਔਖ ਇਸ ਚੀਜ਼ ਦੀ ਆਉਂਦੀ ਹੈ ਕਿ ਖੁੱਲ੍ਹਾ ਪਾਣੀ ਜਿੱਦਾਂ ਲਾਇਕ ਸਮੁੰਦਰ ਹੋ ਗਿਆ ਸਮੁੰਦਰ ਦੇ ਕੰਢੇ ਜੇ ਅਗਰ ਆਪਾਂ ਸਵੀਮਿੰਗ ਕਰਦੇ ਹਾਂ ਕਈ ਅਣਨੋਨ ਜਿਹਨਾਂ ਨੂੰ ਸਵੀਮਿੰਗ ਨਹੀਂ ਆਉਂਦੀ ਜਿਨ੍ਹਾਂ ਨੂੰ ਸਵੀਮਿੰਗ ਬਹੁਤ ਘੱਟ ਆਉਂਦੀ ਆ ਉਹ ਕੀ ਕਰਦੇ ਨੇ ਕਿ ਪਾਣੀ ਦੇ ਕੰਢੇ ਜਾ ਕੇ ਉੱਥੇ ਮਸਤੀ ਕਰਦੇ ਨੇ ਅਤੇ ਜਦੋਂ ਵੇਵਸ ਆਉਂਦੀ ਆ ਪਾਣੀ ਦੀ ਲਹਿਰਾਂ ਆਉਂਦੀਆਂ ਬਹੁਤ ਵੱਡੀਆਂ ਵੱਡੀਆਂ ਤਾਂ ਉਹ ਲਹਿਰਾਂ ਦੇ ਨਾਲ਼ ਆਪਣੇ ਨਾਲ਼ ਉਹਨਾਂ ਨੂੰ ਖਿੱਚ ਕੇ ਸਮੁੰਦਰ ਦੇ ਅੰਦਰ ਲੈ ਜਾਂਦੀ ਆ ਅਤੇ ਉਹਨਾਂ ਦਾ ਉਹਦੇ 'ਚੋਂ ਨਿਕਲਣਾ ਬੜਾ ਮੁਸ਼ਕਿਲ ਹੋ ਜਾਂਦਾ ਆ ਅਤੇ ਜੋ ਬੰਦਾ ਸਵੀਮਿੰਗ ਸਮੁੰਦਰ ਦੇ ਕੰਢੇ ਸਵੀਮਿੰਗ ਕਰਨਾ ਚਾਹੁੰਦਾ ਕਿਨਾਰੇ ਸਵੀਮਿੰਗ ਕਰਨਾ ਚਾਹੁੰਦਾ ਆ ਅਤੇ ਉਹਨਾਂ ਦੇ ਵਾਸਤੇ ਆਹੀ ਆ ਕਿ ਉਹ ਅਗਰ ਸਵੀਮਿੰਗ ਨਹੀਂ ਆਉਂਦੀ ਤਾਂ ਉਦੋਂ ਤਾਂ ਪਾਣੀ ਨਾਲ਼ ਮਜ਼ਾਕ ਨਾ ਕਰਨ ਜੇ ਫਿਰ ਵੀ ਕਰਨਾ ਚਾਹੁੰਦੇ ਆ ਅਤੇ ਕਿਸੇ ਜੋ ਜਾਣਕਾਰੀ ਰੱਖਦਾ ਆ ਉਹਦੇ ਸ ਥਰੂ ਜੋ ਕਹਿੰਦੇ ਜਾਂ ਜੋ ਉਹ ਦੱਸਦੇ ਆ ਜੋ ਗਾਈਡੈਂਸ ਦਿੰਦੇ ਆ ਉਹਨਾਂ ਦੇ ਥਰੂ ਹੀ ਸਵੀਮਿੰਗ ਕਰਨ ਅਦਰਵਾਈਜ਼ ਸੋ ਨਾ ਕਰਨ ਜਿੱਦਾਂ ਕਈ ਥਾਵਾਂ 'ਤੇ ਹੋਰ ਵੀ ਦੇਖਿਆ ਗਿਆ ਜਿੱਦਾਂ ਵਗਦੇ ਦਰਿਆ ਦੇ ਵਿੱਚ ਜਿੱਦਾਂ ਪਾਣੀ ਦਾ ਪ੍ਰੈਸ਼ਰ ਸਲੋਅ ਹੁੰਦਾ ਆ ਜੇ ਪਾਣੀ ਦਾ ਵੇਵ ਸਲੋਅ ਹੁੰਦੀ ਆ ਉੱਥੇ ਕਰਨਾ ਪਸੰਦ ਕਰਦੇ ਆ ਪਰ ਕਈ ਥਾਵਾਂ 'ਤੇ ਦੇਖਿਆ ਗਿਆ ਏ ਕਿ ਕਈ ਥਾਵਾਂ 'ਤੇ ਇਹ ਐਲਗੀ ਜਿੱਦਾਂ ਕਿ ਮਤਲਬ ਕਿ ਕਈ ਕਹਿ ਲਓ ਜਦੋਂ ਤਿਲਕਣ ਥਾਵਾਂ ਹੁੰਦੀ ਚੱਟਾਨਾਂ ਤਿਲਕਣ ਥਾਵਾਂ ਹੁੰਦੀ ਆ ਉਹ 'ਚ ਕਰਦੇ ਆ ਅਤੇ ਕਈ ਵੇਲੇ ਪਾਣੀ ਦਾ ਪ੍ਰੈਸ਼ਰ ਬਹੁਤ ਤੇਜ਼ ਹੋ ਜਾਂਦਾ ਅਤੇ ਜਿਹਦੇ ਕਰਕੇ ਉਹ ਆਪਣੇ ਨਾਲ਼ ਉਹਨਾਂ ਨੂੰ ਵਹਾ ਕੇ ਲੈ ਜਾਂਦਾ ਆ ਅਤੇ ਉਹਨਾਂ ਦੇ ਕਰਕੇ ਉਹਨਾਂ ਦੀ ਚੱਟਾਨਾਂ ਦੇ ਨਾਲ਼ ਟੱਕਰ ਹੋ ਸਕਦੀ ਹੈ ਅਤੇ ਇੱਦਾਂ ਦੀ ਜਗ੍ਹਾ ਦੇ ਵਿੱਚ ਸਵੀਮਿੰਗ ਤਾਂ ਪਹਿਲੀ ਗੱਲ ਨਾ ਕਰੋ ਹੁਸ਼ਿਆਰੀ ਨਾ ਦਿਖਾਓ ਅਤੇ ਜੇ ਜੋ ਅਗਰ ਕਿਸੇ ਨੇ ਰੂਲਸ ਰੈਗੁਲੇਸ਼ਨ ਕੋਈ ਲਿਖੇ ਆ ਉਹਨੂੰ ਪ੍ਰੋਪਰ ਫੋਲੋ ਕਰੋ ਠੀਕ ਆ ਨਾ ਅਤੇ ਤਾਂ ਕਿ ਤੁਹਾਨੂੰ ਜਾਂ ਤੁਹਾਨੂੰ ਆਮ ਲੋਕਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਜੇ ਤੁਹਾਨੂੰ ਸਵੀਮਿੰਗ ਆਉਂਦੀ ਵੀ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਖੁੱਲ੍ਹੇ ਪਾਣੀ ਦੇ ਵਿੱਚ ਸਵੀਮਿੰਗ ਕਰਨਾ ਔਰ ਇੱਕ ਸਵੀਮਿੰਗ ਪੂਲ 'ਤੇ ਸਵੀਮਿੰਗ ਕਰਨ ਦੇ ਵਿੱਚ ਬਹੁਤ ਜ਼ਿਆਦਾ ਫ਼ਰਕ ਹੁੰਦਾ ਆ ਅਤੇ ਆਪਣੇ ਆਪ ਨੂੰ ਉਨਾਂ ਹੀ ਰੱਖੋ ਕਿ ਤੁਸੀਂ ਆਪ ਜਿੰਨਾਂ ਸਵੀਮਿੰਗ ਕਰ ਸਕਦੇ ਹੋ ਉਨਾਂ ਹੀ ਕਰੋ ਕਈ ਥਾਵਾਂ ਦੇ ਵਿੱਚ ਟੂਰਿਸਟ ਪਲੇਸ ਦੇ ਵਿੱਚ ਦੇਖਿਆ ਗਿਆ ਕਿ ਬੱਚੇ ਫਨ ਫਨ ਦੇ ਵਿੱਚ ਪਾਣੀ ਦੇ ਵਿੱਚ ਚਲੇ ਤਾਂ ਜਾਂਦੇ ਆ ਜਿਹਨਾਂ ਨੂੰ ਤੈਰਨਾ ਨਹੀਂ ਆਉਂਦਾ ਉਹਨਾਂ ਦੇ ਲਈ ਬਹੁਤ ਔਖੀ ਹੋ ਜਾਂਦੀ ਆ ਅਤੇ ਅਗਰ ਜੇ ਤੁਹਾਨੂੰ ਸ਼ੌਂਕ ਹੈਗਾ ਆ ਤਾਂ ਪਹਿਲਾਂ ਉਸ ਚੀਜ਼ ਨੂੰ ਪ੍ਰੋਪਰਲੀ ਸਿੱਖੋ ਰੂਲਸ ਫੋਲੋ ਕਰੋ ਅਤੇ ਫਿਰ ਸਵੀਮਿੰਗ ਕਰੋ ਅਤੇ ਕਿਉਂਕਿ ਸੇਫਟੀ ਇਜ ਫਸਟ